ਗੁਡ ਮੋਰਨਿੰਗ ਜੀ ਹਾਂਜੀ ਹਾਂਜੀ ਹਾਂਜੀ ਬਤਾਈਏ ਹਾਂਜੀ ਹਾਂਜੀ ਐਲਆਈਸੀ ਦੇਖੋ ਜੇ ਤੁਸੀਂ ਮੈਨੂੰ ਦੱਸੋ ਕਿਹੜੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਹੈਲਥ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ ਉਸ ਤਰੀਕੇ ਨਾਲ ਫਿਰ ਮੈਂ ਅੱਛਾ ਜੀ ਹੈਲਥ ਇੰਸ਼ੋਰੈਂਸ ਦੇਖੋ ਆਪਾਂ ਕੋਲ ਪਲੈਨ ਹੈਗੇ ਆ ਟੈਂਨ ਥਾਊਜੈਂਟ ਪਰ ਈਅਰ ਦਾ ਉਹਦੇ ਵਿੱਚ ਤੁਸੀਂ ਤੁਹਾਡੀ ਇੱਛਾ ਹੈ ਅਤੇ ਤੁਸੀਂ ਮੰਥਲੀ ਜਾਂ ਤੁਸੀਂ ਹਾਫ ਈਅਰਲੀ ਜਾਂ ਤੁਸੀਂ ਤਿੰਨ ਮੰਥ ਦੀ ਵੀ ਕਰਵਾ ਸਕਦੇ ਹੋ ਅਤੇ ਜੇ ਤੁਸੀਂ ਛੇ ਮਹੀਨੇ ਦੀ ਕਰਵਾਉਣੀ ਹੈ ਅਤੇ ਉਹਦੇ ਵਿੱਚ ਤੁਹਾਨੂੰ ਪੰਜ ਹਜ਼ਾਰ ਕਰਕੇ ਦੇਣਾ ਪਊਗਾ ਦੋ ਵਾਰ ਜੇ ਤੁਸੀਂ ਤਿੰਨ ਮਹੀਨੇ ਦੀ ਕਰਵਾਉਣੀ ਹੈ ਅਤੇ ਉਹਦੇ 'ਚ ਤੁਹਾਨੂੰ ਪੱਚੀ ਪੱਚੀ ਸੋ ਰੁਪਈਆ ਕਰਕੇ ਚਾਰ ਵਾਰ ਦੇਣਾ ਪਏਗਾ ਸਾਲ ਬਾਅਦ ਠੀਕ ਹੈ ਅਤੇ ਤੁਹਾਨੂੰ ਉਹਦੇ ਵਿੱਚ ਅੱਠ ਪ੍ਰਸੈਂਟ ਵਿਆਜ ਲੱਗੇਗਾ ਔਰ ਇਹ ਜਿਹੜਾ ਪਲੈਨ ਹੈਗਾ ਇਹ ਦੋ ਸਾਲ ਦਾ ਚੱਲੇਗਾ ਪਹਿਲੇ ਉਸ ਤੋਂ ਬਾਅਦ ਇਹ ਤੁਸੀਂ ਵਧਾ ਵੀ ਸਕਦੇ ਹੋ ਅੱਗੇ ਠੀਕ ਆ ਅਤੇ ਇਹਦੇ ਵਿੱਚ ਸਾਰਾ ਤੁਹਾਡਾ ਆ ਜਾਏਗਾ ਹੋਸਪਿਟਲ ਦੇ ਬੈਡ ਦਾ ਖਰਚਾ ਜੋ ਵੀ ਤੁਸੀਂ ਪ੍ਰਾਈਵੇਟ ਰੂਮ ਲੈਣਾ ਚਾਹੁੰਦੇ ਹੋ ਜਾਂ ਕੋਈ ਵੀ ਰੂਮ ਲੈਣਾ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਸਾਰਾ ਫ੍ਰੀ ਔਫ ਕੋਸਟ ਹੋਏਗਾ ਹੈਲਥ ਇੰਸ਼ੋਰੈਂਸ ਵਿੱਚ ਹੀ ਸਾਰਾ ਆ ਜੇਗਾ ਠੀਕ ਹੈ ਜੀ ਹਾਂਜੀ ਫੁਲ ਫੈਮਲੀ ਪੈਕੇਜ ਵੀ ਹੁੰਦਾ ਮੈਮ ਅਤੇ ਸਿੰਗਲ ਪਰਸਨ ਦਾ ਵੀ ਹੁੰਦਾ ਠੀਕ ਹੈ ਹਾਂਜੀ ਫੁਲ ਫੈਮਲੀ ਦਾ ਦੇਖੋ ਜੀ ਥਰਟੀ ਥਾਊਜੈਂਟ ਤੋਂ ਲੈ ਕੇ ਪੰਜਾਹ ਹਜ਼ਾਰ ਇੱਕ ਲੱਖ ਤੱਕ ਵੀ ਹੋ ਸਕਦਾ ਉਹ ਤੁਹਾਡੀ ਪੋਕਿਟ 'ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਖਰਚ ਕਰਨਾ ਚਾਹੁੰਦੇ ਹੋ ਠੀਕ ਹੈ ਡਿਸਕਾਊਂਟ ਫੁੱਲ ਫੈਮਲੀ ਅਤੇ ਜੇ ਤੁਸੀਂ ਕਰਵਾਓਗੇ ਅਤੇ ਉਹਦੇ ਉੱਪਰ ਹੋ ਸਕਦਾ ਥੋੜ੍ਹਾ ਬਹੁਤ ਬਾਕੀ ਹਾਂਜੀ ਫਾਈਵ ਥਾਊਜੈਂਟ ਤੁਹਾਨੂੰ ਲੈਸ ਹੋ ਸਕਦਾ ਅਤੇ ਫੁੱਲ ਫੈਮਲੀ ਦਾ ਕਰਵਾਉਂਦੇ ਹੋ ਹਾਂਜੀ ਅਸੀਂ ਵਿਜਿਟ ਕਰ ਸਕਦੇ ਹਾਂ ਘਰੇ ਤੁਹਾਡੇ ਘਰੇ ਅਸੀਂ ਆਪਣਾ ਏਜੰਟ ਭੇਜ ਸਕਦੇ ਹਾਂ ਤੁਸੀਂ ਐਨੀਟਾਈਮ ਸਾਨੂੰ ਕਾਲ ਕਰ ਸਕਦੇ ਹੋ ਮੋਰਨਿੰਗ ਤੋਂ ਹਾਂਜੀ ਨੌ ਵਜੇ ਤੋਂ ਸਟਾਰਟ ਕਰਕੇ ਰਾਤ ਦੇ ਨੌ ਵਜੇ ਤੱਕ ਸਾਨੂੰ ਕਾਲ ਕਰ ਸਕਦੇ ਹਾਂਜੀ ਨੌ ਵਜੇ ਸਵੇਰੇ ਮੋਰਨਿੰਗ 'ਚ ਖੁੱਲ੍ਹ ਜਾਂਦਾ ਔਰ ਸ਼ਾਮ ਨੂੰ ਵੀ ਨੌ ਵਜੇ ਤੱਕ ਅਸੀਂ ਆਪਣਾ ਸਾਡਾ ਆਫਿਸ ਬਸਤੀ ਜੋਧੇਵਾਲ ਹੈਗਾ ਜੀ ਹਾਂਜੀ ਰਾਹੋਂ ਰੋਡ 'ਤੇ ਹੈਗਾ ਬਸਤੀ ਜੋਧੇਵਾਲ ਆਪਣੇ ਸਟੇਟ ਬੈਂਕ ਦੇ ਨਾਲ ਹੀ ਹੈਗਾ ਠੀਕ ਹੈ ਜੀ ਥੈਂਕ ਯੂ ਓਕੇ ਥੈਂਕ ਯੂ